ਹੈਲੋ ਹਾਂਜੀ ਜਵੈਲਰ ਸ਼ੋਪ ਤੋਂ ਗੱਲ ਕਰ ਰਹੇ ਓ ਜੀ ਹਾਂਜੀ ਮੈਂ ਕੋਮਲਪ੍ਰੀਤ ਬੋਲਦੀ ਸੀ ਜੀ ਹਾਂਜੀ ਸਾਡੇ ਵੱਡੇ ਬਜ਼ੁਰਗ ਮੰਮੀ ਡੈਡੀ ਵੀ ਥੋਡੇ ਤੋਂ ਗਹਿਣੇ ਲੈ ਕੇ ਜਾਂਦੇ ਸੀ ਜੀ ਹਾਂਜੀ ਵਧੀਆ ਕੁਆਲਟੀ ਸੀ ਥੋਡੇ ਗਹਿਣਿਆਂ ਦੀ ਹਾਂਜੀ ਮੇਰੀ ਮੈਰਿਜ ਐ ਤੇ ਮੈਨੂੰ ਮੇਰੀ ਮੈਰਿਜ ਲਈ ਗਹਿਣੇ ਬਨਵਾਣੇ ਐ ਜੀ ਹਾਂਜੀ ਮੈਨੂੰ ਇੱਕ ਤਾਂ ਜੀ ਜੁਗਨੀ ਸੈੱਟ ਬਨਵਾਨਾ ਜੀ ਹਾਂਜੀ ਹਾਂਜੀ ਝੂਮਰ ਐ ਜੀ ਝੂਮਰ ਵਾਲੀ ਸੂਈਆਂ ਹਾਂਜੀ ਹਾਂਜੀ ਹਾਂਜੀ ਮੈਨੂੰ ਹਾਂਜੀ ਮੈਨੂੰ ਇੱਕ ਜੁਗਨੀ ਸੈੱਟ ਬਨਵਾਨਾ ਜੀ ਤੇ ਇੱਕ ਹਾਂਜੀ ਇੱਕ ਮੈਨੂੰ ਟੌਪਸ ਟੌਪਸਾਂ ਦਾ ਜੋੜਾਂ ਬਨਵਾਣਾ ਜੀ ਤੇ ਸੋਹਰਾ ਵਾਸਤੇ ਅੰਗੂਠੀ ਬਨਵਾਨੀ ਐ ਦੋਨਾਂ ਵਾਸਤੇ ਅੰਗੂਠੀਆਂ ਦੋ ਹਾਂਜੀ ਵਚੋਲੇ ਵਾਸਤੇ ਬਣਵਾਨੀ ਐ ਜੀ ਹਾਂਜੀ ਇੱਕ ਸਪੈਸ਼ਲੀ ਮੇਰੇ ਹਸਬੈਂਡ ਲਈ ਬਣਵਾਣੀ ਐ ਜੀ ਹਾਂਜੀ ਆਪਣੇ ਸੋਨੇ ਦਾ ਰੇਟ ਕੀ ਐ ਜੀ

ਹਾਂਜੀ ਉਹ ਤਾਂ ਮੈਨੂੰ ਦਸ ਦਿਨਾਂ ਦੇ ਅੰਦਰ ਅੰਦਰ ਚਾਈਦਾ ਜੀ ਹਾਂਜੀ ਮੈਂ ਫਿਰ ਕਦੋਂ ਆਵਾਂ ਜੀ ਸਾਈ ਦੇਣ ਪਹਿਲਾਂ ਪੇਮੈਂਟ ਸਾਈ ਕਿੰਨੀ ਦੇਣੀ ਪਾਊਗੀ ਜੀ ਪਹਿਲਾਂ ਸਾਈ ਕਿੰਨੀ ਦੇਣੀ ਪਊਗੀ ਜੀ ਗਹਿਣਿਆਂ ਵਾਸਤੇ ਹਾਂਜੀ ਹਾਂਜੀ ਹਾਂਜੀ ਨਈਂ ਉਹ ਤਾਂ ਕੋਈ ਗੱਲ ਨੀ ਜੀ ਬੱਟ ਪਰ ਗਹਿਣੇ ਵਧੀਆ ਹੋਣੇ ਚਾਈਦੇ ਐ ਕਿ ਸਾਈ ਦਾ ਤਾਂ ਕੋਈ ਗੱਲ ਨੀ ਅਸੀਂ ਸਾਈ ਕੱਲ੍ਹ ਦੇ ਦਾਂਗੇ ਥੋਨੂੰ ਆ ਕੇ ਅੱਛ ਵਧੀਆ ਡਿਜ਼ਾਈਨ ਹੋਵੇ ਅੱਜ ਕੱਲ੍ਹ ਆਲ਼ਾ ਹਾਂਜੀ ਹਾਂਜੀ ਘੜੀ ਤੇ ਹਾਂਜੀ ਕੜਾ ਵਗੈਰਾ ਹਾਂਜੀ ਫ਼ੇਰ ਅਸੀਂ ਕੱਲ੍ਹ ਆਵਾਂਗੇ ਤੇ ਸਾਈ ਦੇ ਜਾਂਗੇ ਠੀਕ ਐ ਜੀ ਓਕੇ